ਜੀ ਭੰਗੜਾ ਐਰੋਬਿਕਸ ਲਈ ਕਈ ਤਰੀਕੇ ਦੇ ਮੁਕਾਬਲੇ ਹੁੰਦੇ ਹਨ ਅਤੇ ਇਸ ਵਿੱਚ ਨੌਜਵਾਨ ਜਿਹੜੇ ਕਿ ਵਿਦਿਆਰਥੀ ਹਨ ਉਹ ਇਸ ਵਿੱਚ ਹਿੱਸਾ ਲੈਂਦੇ ਹਨ ਅਤੇ ਵੱਧ ਚੜ ਕੇ ਉਹ ਭਾਗ ਲੈਂਦੇ ਹਨ ਅਤੇ ਭੰਗੜਾ ਪੰਜਾਬ ਦਾ ਸਭ ਤੋਂ ਵਧੀਆ ਨਾਚ ਮੰਨਿਆ ਜਾਂਦਾ ਹੈ ਅਤੇ ਉਹਦੇ ਵਿੱਚ ਜਿਹੜੇ ਵਿਦਿਆਰਥੀ ਹਨ ਉਹ ਟਰੇਨਿੰਗ ਲੈਂਦੇ ਹਨ ਅਤੇ ਪਾਰਟੀਸੀਪੇਟ ਕਰਦੇ ਹਨ